ਹੈਲੋ ਹਾਂਜੀ ਜੀ ਓਕੇ ਹਾਂਜੀ ਜ਼ਰੂਰ ਜੀ ਦੇਖੋ ਜੀ ਅਗਰ ਤੁਸੀਂ ਲੋਕਲ ਕਿਤੇ ਜਾਣਾ ਚਾਹੁੰਦੇ ਹੋ ਜਿਸ ਤਰ੍ਹਾਂ ਦਰਬਾਰ ਸਾਹਿਬ ਜਾਂ ਹੋਰ ਇੱਥੇ ਕਾਫ਼ੀ ਧਾਰਮਿਕ ਗੁਰਦੁਆਰੇ ਵਗੈਰਾ ਨੇ ਤਾਂ ਤੁਸੀਂ ਬੈਟਰੀ ਵਾਲਾ ਰਿਕਸ਼ਾ ਕਰ ਸਕਦੇ ਹੋ ਇੱਥੇ ਦਸ ਰੁਪਏ ਸਵਾਰੀ ਜਿਹੜੀ ਆ ਬੱਸ ਸਟੈਂਡ ਤੋਂ ਲੈ ਕੇ ਬੋੜੀ ਵਾਲੇ ਚੌਂਕ ਤੱਕ ਫਿਕਸ ਪ੍ਰਾਈਜ ਹੈ ਹਾਂਜੀ ਹੋਰ ਕੁਛ ਜੀ ਦੂਰ ਬੇਟਾ ਦੇਖੋ ਜੇ ਤੁਸੀਂ ਦਸ ਵੀਹ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੈ ਤਾਂ ਤੁਹਾਨੂੰ ਜਿਹੜੀ ਲੋਕਲ ਬੱਸ ਬਹੁਤ ਵਧੀਆ ਰਹੇਗੀ ਹੋਰ ਕਿਤੇ ਦੂਰ ਜਾਣ ਦੀ ਤੁਸੀਂ ਹਾਂਜੀ ਕੈਬ ਦੀ ਸਹੂਲਤ ਵੀ ਇੱਥੇ ਬਹੁਤ ਵਧੀਆ ਹੈ ਓਲਾ ਵਗੈਰਾ ਤੁਸੀਂ ਘਰ ਬੈਠੇ ਹੀ ਬੁੱਕ ਕਰ ਸਕਦੇ ਹੋ ਹੋਰ ਕੁਛ ਓਕੇ ਜੀ